ਸਤਿ ਸ਼੍ਰੀ ਅਕਾਲ ਸਰ ਮੈਂ ਮੀਨਾਕਸ਼ੀ ਪਠਾਨਕੋਟ ਤੋਂ ਬੋਲ ਰਹੀ ਹਾਂ ਅਤੇ ਮੈਨੂੰ ਬਚਪਨ ਤੋਂ ਹੀ ਫਿਲਮਾਂ ਵੇਖਣ ਦਾ ਬਹੁਤ ਸ਼ੌਂਕ ਹੈ ਅਤੇ ਫਿਲਮਾਂ ਵਿੱਚੋਂ ਫਿਲਮ ਵਿੱਚੋਂ ਐਕਟਰਾਂ ਵਿੱਚੋਂ ਮੇਰਾ ਫੇਵਰੇਟ ਐਕਟਰ ਸਲਮਾਨ ਖਾਨ ਹੈ ਜੋ ਕਿ ਮੈਨੂੰ ਬਹੁਤ ਪਸੰਦ ਹੈ ਉਹਨਾਂ ਦੀ ਫਿਲਮਾਂ ਮੈਨੂੰ ਸਾਰੀਆਂ ਹੀ ਬਹੁਤ ਪਸੰਦ ਹੈ ਜੋ ਜੋ ਬਹੁਤ ਹੀ ਵਧੀਆ ਹੁੰਦੀਆਂ ਹਨ ਮੈਨੂੰ ਛੱਡ ਕੇ ਭਾਰਤ ਵਿੱਚ ਸਭ ਹੀ ਨਾਗਰਿਕਾਂ ਨੂੰ ਇਹ ਐਕਟਰ ਬਹੁਤ ਹੀ ਪਸੰਦ ਹੈ ਇਹਨਾਂ ਦੀ ਕਈ ਫਿਲਮਾਂ ਹੈ ਜੋ ਮਨ ਦਿਲ ਨੂੰ ਛੂੰਹਦੀਆਂ ਹਨ ਜਿਵੇਂ ਕਿ ਬਜਰੰਗੀ ਭਾਈਜਾਨ ਤੇਰੇ ਨਾਮ ਦੇ ਦਿਲ ਦੇ ਚੁੱਕੇ ਸਨਮ ਅਤੇ ਟਾਈਗਰ ਜਿੰਦਾ ਹੈ ਕਈ ਤਰ੍ਹਾਂ ਦੀਆਂ ਕਈ ਤਰ੍ਹਾਂ ਦੀਆਂ ਫਿਲਮਾਂ ਹਨ ਜੋ ਜਿਸ ਵਿੱਚ ਇਹਨਾਂ ਅਤੇ ਕ ਕਈ ਬਹੁਤ ਹੀ ਵਧੀਆ ਕਿਰਦਾਰ ਨਿਭਾਇਆ ਹੈ ਅਤੇ ਟਾਈਗਰ ਜਿੰਦਾ ਹੈ ਫਿਲਮ ਵਿੱਚ ਸਨਮਾਨ ਖਾਨ ਨੇ ਆਰਮੀ ਵਾਲੇ ਬਹੁਤ ਹੀ ਵਧੀਆ ਵਧੀਆ ਬਹੁਤ ਹੀ ਵਧੀਆ ਕਿਰਦਾਰ ਨਿਭਾਇਆ ਹੈ ਅਤੇ ਬਹੁਤ ਹੀ ਵਧੀਆ ਸੰਦੇਸ਼ ਦਿੱਤਾ ਹੈ ਜਿਸ ਵਿੱਚ ਦੇਸ਼ ਬਾਰੇ ਉਹਨਾਂ ਨੇ ਕਾਫ਼ੀ ਨੌਲੇਜ ਦਿੱਤੀ ਹੈ ਅਤੇ ਇਹ ਬਹ ਇਹ ਬਹੁਤ ਹੀ ਵਧੀਆ ਐਕਟਰ ਹੈ ਮੇਰਾ ਸਭ ਸਭ ਤੋਂ ਫੇਵਰਟ ਐਕਟਰ ਹੈ ਮੈਨੂੰ ਇਹਨਾਂ ਦੀ ਬੋਡੀ ਬਹੁਤ ਪਸੰਦ ਹੈ ਸਲਮਾਨ ਖਾਨ ਮਾਈ ਸਲਮਾਨ ਖਾਨ ਮੇਰਾ ਸਭ ਤੋਂ ਪਸੰ ਮਨ ਪਸੰਦ ਕਿਰਦਾਰ ਹੈ